ਪਿੰਡਾਂ ਵਿੱਚ ਗ੍ਰਾਮ ਪੰਚਾਇਤ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਮੈਂ ਭਿੱਖੀ ਵਿੱਚ ਰਹਿਣ ਵਾਲੀ ਹਾਂ ਅਤੇ ਸਾਡੇ ਭਿੱਖੀ ਸ਼ਹਿਰ ਵਿੱਚ ਗ ਨਗਰ ਕੌਂਸਲ ਹੈ ਨਗਰ ਕੌਂਸਲ ਹਰ ਕੰਮ ਪੂਰੇ ਵਧੀਆ ਤਰੀਕੇ ਨਾਲ ਕਰਦੀ ਹੈ ਮੈਨੇ ਵੈਸੇ ਮੈਨੇ ਤਾਂ ਕਦੇ ਵੋਟ ਪਾਈ ਨਹੀਂ ਪਰ ਮੈਂ ਆਪਦੇ ਡੈਡੀ ਨੂੰ ਦੇਖਿਆ ਜ਼ਰੂਰ ਹੈਗਾ ਕਿ ਵੀ ਉਹ ਹਰ ਪੰਜ ਸਾਲ ਬਾਅਦ ਰੈਲੀਆਂ 'ਤੇ ਜਾਂਦੇ ਨੇ ਵੋਟ ਪਾਉਂਦੇ ਨੇਗੇ ਪੰਚਾਇਤ ਦੇ ਲੋਕਾਂ ਨੂੰ ਸਾਡੇ ਵਾਰਡ ਦੇ ਐਮ ਸੀ ਸੁਖਦੀਪ ਸਿੰਘ ਜੀ ਨੇ ਠੀਕ ਹੈ ਇਹ ਹਰ ਕੰਮ ਵਧੀਆ ਤਰੀਕੇ ਨਾਲ ਕਰਵਾਉਂਦੇ ਨੇ ਅਗਰ ਆਪਾਂ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਜਿਵੇਂ ਆਪਾਂ ਸੜਕਾਂ ਬਣਵਾਉਣੀਆਂ ਨੇ ਜਾਂ ਫਿਰ ਨਾਲੀਆਂ ਪੱਕੀਆਂ ਕਰਵਾਉਣੀਆਂ ਨੇ ਪਾਣੀ ਦੀ ਸਪਲਾਈ ਨੂੰ ਠੀਕ ਕਰਵਾਉਣਾ ਨਹੀਂ ਆ ਰਹੀ ਤਾਂ ਅਸੀਂ ਸੁਖਦੀਪ ਐਮ ਸੀ ਨੂੰ ਕਹਿ ਦਿੰਦੇ ਹਾਂ ਉਹ ਕੀ ਕਰਦੇ ਨੇ ਸਭ ਕੰਮ ਠੀਕ ਕਰਵਾ ਦਿੰਦੇ ਨੇ ਜੇ ਸੜਕਾਂ ਨਹੀਂ ਪੱਕੀਆਂ ਹੁੰਦੀਆਂ ਤਾਂ ਪੱਕੀਆਂ ਕਰਵਾ ਦਿੰਦੇ ਹੈ ਜੇ ਸਫਾਈ ਕਰਮਚਾਰੀ ਨੇ ਸਫਾਈ ਨਹੀਂ ਕੀਤੀ ਹੁੰਦੀ ਬਾਹਰ ਚੌਂਕ 'ਚ ਤਾਂ ਅਸੀਂ ਐਮ ਸੀ ਨੂੰ ਕਹਿ ਕੇ ਸਫਾਈ ਕਰਵਾ ਦਿੰਦੇ ਹਾਂ ਉਹ ਕਹਿ ਦਿੰਦੇ ਨੇ ਹਰ ਟਾਈਮ 'ਤੇ ਮਤਲਬ ਜਦੋਂ ਵੀ ਆਪਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਇਸ ਤਰੀਕੇ ਦੀ ਤਾਂ ਸ ਐਮ ਸੀ ਆਰਾਮ ਨਾਲ ਸੋਲਵ ਕਰ ਦਿੰਦੇ ਨੇ ਇੱਦਾਂ ਹੀ ਸੇਮ ਆਪਣਾ ਪਿੰਡਾਂ ਵਿੱਚ ਹੁੰਦਾ ਹੈਗਾ ਪਿੰਡਾਂ 'ਚ ਗ੍ਰਾਮ ਪੰਚਾਇਤ ਹੀ ਸਾਰਾ ਕੰਮ ਕਰਦੀ ਹੈ ਪਹਿਲਾਂ ਪਿੰਡਾਂ 'ਚ ਪਿੰਡ ਜਾਣ ਦਾ ਘੱਟ ਜੀਅ ਜਿਹਾ ਕਰਦਾ ਸੀ ਕਿਉਂਕਿ ਉੱਥੇ ਕਈ ਵਾਰ ਸੜਕਾਂ ਪੱਕੀਆਂ ਨਹੀਂ ਹੁੰਦੀਆਂ ਸੀ ਹਰ ਚੀਜ਼ ਟੋਏ ਬਣੇ ਰਹਿੰਦੇ ਸੀਗੇ ਸੜਕਾਂ 'ਤੇ ਸਪਲਾਈ ਨਹੀਂ ਵਧੀਆ ਆਉਂਦੀ ਸੀ ਪਾਣੀ ਦੀ ਪਰ ਹੁਣ ਗ੍ਰਾਮ ਪੰਚਾਇਤ ਨੇ ਬਹੁਤ ਵਧੀਆ ਸਹੂਲਤਾਂ ਪ੍ਰਦਾਨ ਕੀਤੀਆਂ ਨੇ ਪਿੰਡਾਂ ਨੂੰ ਸੜਕਾਂ ਬਹੁਤ ਵਧੀਆ ਪੱਕੀਆਂ ਕਰਵਾ ਰੱਖੀਆਂ ਨੇ ਪਿੰਡਾਂ 'ਚ ਵੀ ਬਹੁਤ ਵਧੀਆ ਪੱਕੀਆਂ ਹੋਈਆਂ ਨੇ ਗ੍ਰਾਮ ਪੰਚਾਇਤ ਆਪਦਾ ਹਰ ਕੰਮ ਵਧੀਆ ਤਰੀਕੇ ਨਾਲ ਕਰਦੀ ਹੈ ਅਗਰ ਪਿੰਡਾਂ 'ਚ ਕੋਈ ਵੀ ਝਗੜਾ ਹੁੰਦਾ ਗਾ ਤਾਂ ਮੈਂ ਦੇਖਿਆ ਗਾ ਮੈਨੂੰ ਤਾਂ ਨਹੀਂ ਪਤਾ ਪਰ ਮੈਨੇ ਡੈਡੀ ਤੋਂ ਸੁਣਿਆ ਗਾ ਇੱਕ ਅੱਧੀ ਵਾਰ ਮੈਂ ਆਹ ਹੁਣੇ ਪਿੱਛੇ ਜੇ ਗਈ ਸੀ ਪਿੰਡ 'ਚ ਦੋ ਕਿਸਾਨਾਂ ਦਾ ਝਗੜਾ ਹੋ ਗਿਆ ਸੀ ਗ੍ਰਾਮ ਪੰਚਾਇਤ ਨੇ ਵਧੀਆ ਤਰੀਕੇ ਨਾਲ ਸੋਲਵ ਕੀਤਾ ਵਧੀਆ ਤਰੀਕੇ ਨਾਲ ਉਸ ਝਗੜੇ ਨੂੰ ਹੱਲ ਕੀਤਾ ਪੰਚਾਇਤ ਬੁਲਾ ਕੇ ਦੋਨਾਂ ਦੇ ਝਗੜਿਆਂ ਦਾ ਨਿਪਟਾਰਾ ਕਰਤਾ ਨਾਲੇ ਦੋਨਾਂ 'ਚ ਆਪਸੀ ਸਮਝੌਤਾ ਕਰਵਾ ਤਾ ਇਸ ਤਰੀਕੇ ਨਾਲ ਗ੍ਰਾਮ ਪੰਚਾਇਤ ਹਰ ਕੰਮ ਨੂੰ ਵਧੀਆ ਤਰੀਕੇ ਨਾਲ ਕਰਦੀ ਹੈ ਲੋੜ ਪੈਣ 'ਤੇ ਹੀ ਆਪਣੀ ਸਹਾਇਤਾ ਬਹੁਤ ਵਧੀਆ ਤਰੀਕੇ ਨਾਲ ਕਰਦੀ ਹੈ